ਵੈਸੇ ਤਾਂ ਗੋਡਿਆਂ ਦੇ ਦਰਦ ਵਾਸਤੇ ਪਿੰਡਾਂ ਵਿੱਚ ਬਹੁਤ ਸਾਰੇ ਘਰੇਲੂ ਜਿਹੜੇ ਹੈਗੇ ਆ ਉਪਚਾਰ ਕੀਤੇ ਜਾਂਦੇ ਹੈਗੇ ਆ ਜਿਹਨਾਂ ਵਿੱਚ ਜਿਹੜੇ ਮੁੱਖ ਤੌਰ 'ਤੇ ਹੈਗੇ ਆ ਉਹ ਹੁੰਦੇ ਹੈਗੇ ਆ ਦੋ ਚਾਰ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਿਆ ਜਿਹਨਾਂ ਵਿੱਚੋਂ ਪਹਿਲਾ ਹੁੰਦਾ ਹੈਗਾ ਹੈ ਵੀ ਜਿੱਦਾਂ ਕਿਸੇ ਬੰਦੇ ਦਾ ਜੇ ਕਹਿੰਦੇ ਨਹੀਂ ਬੰਦੇ ਦਾ ਗੋਡਿਆਂ 'ਚ ਦਰਦ ਹੁੰਦਾ ਹੈਗਾ ਹੈ ਤਾਂ ਉਹ ਪਹਿਲਾਂ ਹੁੰਦਾ ਵਾ ਪਿੰਡਾਂ 'ਚ ਵੀ ਪਹਿਲਾਂ ਉਹਦੀ ਟਕੋਰ ਕਰ ਲਓ ਵੀ ਇਹਦੇ ਨਾਲ ਵੀ ਕਾਫੀ ਹੱਦ ਤੱਕ ਫਰਕ ਪੈਂਦਾ ਜੇ ਟਕੋਰ ਨਾਲ ਇਸ ਤੋਂ ਇਲਾਵਾ ਜਿਹੜੇ ਹੋਰ ਹੁੰਦੇ ਹੈਗੇ ਹੈ ਜਿੱਦਾਂ ਬਈ ਮੰਨ ਲਓ ਜਿਹੜੀਆਂ ਰੋਟੀ ਵਗੈਰਾ ਹੁੰਦੀ ਹੈਗੀ ਆ ਉਹ ਤੇਲ ਤੂਲ ਲਾ ਕੇ ਉਹ ਨਾ ਗੋਡੇ ਪਰ ਬੰਨ੍ਹ ਲਓ ਉਹਨੂੰ ਜਿੱਥੇ ਜੇ ਦੁੱਖਦਾ ਹੈਗਾ ਹੈ ਉੱਥੇ ਬੰਨ੍ਹ ਲਉ ਉਹਨੂੰ ਅਤੇ ਜਿਹੜਾ ਤੀਜਾ ਹੁੰਦਾ ਹੈਗਾ ਹੈ ਵੀ ਜਿੱਦਾਂ ਹੁਣ ਕਿਹੜੀਆਂ ਲੋਕਲ ਜਿਹੜੀਆਂ ਜਿੱਦਾਂ ਬੰਗਾਲੀ ਬਾਬਾ ਵਗੈਰਾ ਹੁੰਦੇ ਹੈ ਜਿਹੜੇ ਲੋਕਲ ਜਿਹੜੇ ਵੈਦ ਪੁਰਾਣੇ ਹੁੰਦੇ ਹੈਗੇ ਉਹਨਾਂ ਦੇ ਦਵਾਈ ਲਈ ਜਿਹੜੇ ਪੁਰਾਣੇ ਹੁੰਦੇ ਆ ਮੰਜੇ ਹੋਏ ਪਿੰਡਾਂ ਵਿੱਚ ਜ਼ਿਆਦਾ ਮਿਲਦੇ ਹੈਗੇ ਆ ਉਹਨਾਂ ਦੇ ਦਵਾਈ ਲੈ ਆਓ ਅਤੇ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਹੈ ਇੱਕ ਹੋਰ ਜਿੱਦਾਂ ਕਹਿੰਦੇ ਹੈਗੇ ਜ਼ਿਆਦਾ ਫਿਰ ਜਿਹੜਾ ਲਾਸਟ ਹੈ ਬੰਗਾਲੀ ਬਾਬੇ ਦੇ ਦਵਾਈ ਲੈ ਆਓ ਵੀ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਬਹੁਤ ਸਾਰੇ ਹੈਗੇ ਆ ਜਿਹੜੇ ਪਿੰਡਾਂ ਵਿੱਚ ਜਿਹੜੇ ਗੋਡਿਆਂ ਦੇ ਦਰਦ ਨੂੰ ਠੀਕ ਕਰਨ ਵਾਸਤੇ ਬਹੁਤ ਸਾਰੇ ਵਿਚਾਰ ਇਸ ਤੋਂ ਇਲਾਵਾ ਵੀ ਕੀਤੇ ਜਾਂਦੇ ਹੈਗੇ ਆ